ਪੁਰਾਣੇ ਸਮੇਂ ਤੋਂ ਹੀ ਜਿਹੜੇ ਲੋਕ ਆ ਉਹ ਕੋਈ ਨਾ ਕੋਈ ਕਿੱਤੇ ਕੰਮ ਕਰਦੇ ਆਏ ਸੀਗੇ ਇਹ ਜਿਹੜੇ ਲੋਕ ਸੀ ਇਹਨਾਂ ਦੇ ਵਿਕਾਸ ਦੇ ਕਾਰਨ ਹੀ ਜਿਹੜਾ ਸਮਾਜ ਸੀਗਾ ਉਹਦਾ ਵਿਕਾਸ ਹੋਣਾ ਉਹਦਾ ਵਿਕਾਸ ਹੋਣ ਲੱਗ ਗਿਆ ਸੀਗਾ ਇਹਨਾਂ ਦੀ ਜਿਹੜੀ ਸ਼ੁਰੂਆਤ ਸੀਗੀ ਇਹਨਾਂ ਦੀ ਇਹਨਾਂ ਲੋਕਾਂ ਦੀ ਸ਼ੁਰੂਆਤ ਸੀਗੀ ਉਹ ਲੋੜ ਤੋਂ ਸ਼ੁਰੂ ਹੋਈ ਹਰ ਇਨਸਾਨ ਨੂੰ ਕੋਈ ਨਾ ਕੋਈ ਲੋੜ ਰਹਿੰਦੀ ਵਾ ਇਸ ਲਈ ਲੋਕਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਲੋਕਾਂ ਦੀਆਂ ਸਾਰੀਆਂ ਲੋੜਾਂ ਬਿਨਾ ਮੁਸ਼ਕਲ ਤੋਂ ਪੂਰੀਆਂ ਹੋ ਸਕਣ ਫੇਰ ਇਹਨਾਂ ਕਿੱਤਿਆਂ ਕੰਮਾਂ ਦੀ ਵੰਡ ਕੀਤੀ ਗਈ ਸੀਗੀ ਜਿਹਦੀ ਜਿੱਦਾਂ ਕਿ ਤਰਨ ਤਾਰਨ ਜ਼ਿਲ੍ਹੇ ਦੇ ਪਿੰਡਾਂ ਦੇ ਕੁਝ ਲੋਕ ਖੇਤੀਬਾੜੀ ਦਾ ਕੰਮ ਕਰਦੇ ਆ ਉਹ ਲੋਕ ਜਿਹੜੇ ਹੈਗੇ ਆ ਉਹ ਅਨਾਜ ਉਗਾਉਂਦੇ ਆ ਸਾਰੇ ਸਾਲ ਉਹ ਲੋਕ ਅਨਾਜ ਦੀ ਦੇਖਭਾਲ ਕਰਦੇ ਆ ਫੇਰ ਬਾਅਦ ਵਿੱਚ ਜਦੋਂ ਫਸਲ ਵੱਡੀ ਹੋ ਜਾਂਦੀ ਆ ਫਿਰ ਉਸ ਫਸਲ ਦੀ ਕਟਾਈ ਹੁੰਦੀ ਆ ਫਿਰ ਬਾਅਦ 'ਚੋਂ ਜਿਹੜਾ ਅਨਾਜ ਹੁੰਦਾ ਆ ਉਹਨੂੰ ਮੰਡੀ 'ਚ ਲੈ ਕੇ ਜਾਂਦੇ ਲੋਕ ਫਿਰ ਬਾਅਦ 'ਚੋਂ ਉਹ ਅੱਧਾ ਅਨਾਜ ਘਰ ਰੱਖ ਲੈਂਦੇ ਆ ਅਤੇ ਅੱਧਾ ਵੇਚ ਆਉਂਦੇ ਆ ਫਿਰ ਇੱਦਾਂ ਜਿਹੜੇ ਲੋਕ ਆਉ ਅਤੇ ਜਿਹੜੇ ਪੈਸੇ ਆ ਉਹ ਵੱਟਦੇ ਆ ਫਿਰ ਉਹਨਾਂ ਪੈਸਿਆਂ ਨਾਲ ਉਹ ਆਪਦਾ ਗੁਜ਼ਾਰਾ ਕਰਦੇ ਘਰ ਦਾ ਫੇਰ ਕਈ ਲੋਕ ਇੱਦਾਂ ਕਰਦੇ ਆ ਕਿ ਉਹਨਾਂ ਨੇ ਮੱਝਾ ਗਾਵਾਂ ਰੱਖੀਆਂ ਹੁੰਦੀਆਂ ਵਾ ਉਹ ਲੋਕ ਮੱਝਾਂ ਗਾਵਾਂ ਵੇਚਦੇ ਹੁੰਦੇ ਆ ਜਾਂ ਉਹਨਾਂ ਦਾ ਦੁੱਧ ਵੇਚ ਕੇ ਉਹ ਆਪਦਾ ਗੁਜ਼ਾਰਾ ਕਰਦੇ ਆ ਅਤੇ ਇੱਦਾਂ ਉਹ ਪੈਸੇ ਵੱਟਦੇ ਆ ਪਿੰਡਾਂ ਵਿੱਚ ਕਈ ਲੋਕ ਜਿਹੜੇ ਉਹ ਸਬਜ਼ੀਆਂ ਬੀਜਦੇ ਆ ਕੱਚੀ ਥਾਂ ਦੇ ਉੱਤੇ ਉਹ ਸਬਜ਼ੀਆਂ ਬੀਜਦੇ ਆ ਫਿਰ ਉਹਨਾਂ ਸਬਜ਼ੀਆਂ ਨੂੰ ਵੇਚਦੇ ਆ ਅਤੇ ਉਹਨੂੰ ਸਬਜ਼ੀਆਂ ਨੂੰ ਵੇਚ ਕੇ ਉਹ ਫਿਰ ਪੈਸੇ ਵੱਟਦੇ ਆ ਅਤੇ ਹੁਣ ਜਿਹੜੇ ਲੋਕ ਸ਼ਹਿਰਾਂ 'ਚ ਰਹਿੰਦੇ ਆ ਜਿਹੜੇ ਸ਼ਹਿਰੀ ਹੁੰਦੇ ਆ ਉਹ ਕੋਈ ਜਣਾ ਬੈਂਕਿੰਗ ਕੋਈ ਬੈਂਕਾਂ ਦੇ ਵਿੱਚ ਜੇ ਸ਼ਹਿਰੀ ਹੁੰਦੇ ਆ ਕੋਈ ਬੈਂਕਾਂ ਦੇ ਵਿੱਚ ਲੱਗਾ ਹੁੰਦਾ ਵਾ ਉਹ ਉੱਥੇ ਕਲਰਕ ਦਾ ਕੰਮ ਮੈਨੇਜਰ ਦਾ ਕੰਮ ਇੱਦਾਂ ਇੱਦਾਂ ਕਰਕੇ ਲੋਕ ਕੰਮ ਕਰਦੇ ਆ ਕੋਈ ਮੈਨੇਜਰ ਲੱਗਾ ਹੁੰਦਾ ਵਾ ਕੋਈ ਕਲਰਕ ਲੱਗਾ ਹੁੰਦਾ ਵਾ ਕੋਈ ਫਾਰਮ ਭਰਦਾ ਆ ਬੈਂਕ ਦੇ ਵਿੱਚ ਉਹ ਫਾਰਮ ਭਰਦਾ ਜਿੱਦਾਂ ਕਿ ਪੈ ਪੈਸੇ ਭਰਨ ਦੇ ਫਾਰਮ ਪੈਸੇ ਕਢਵਾਉਣ ਦਾ ਫਾਰਮ ਇਹ ਕੰਮ ਕਰਦੇ ਆ ਕਈ ਜਿਹੜੇ ਲੋਕ ਆ ਉਹ ਲੱਕੜ ਦਾ ਕੰਮ ਕਰਦੇ ਆ ਕਾਰਪੇਂਟਰ ਦਾ ਲੱਕੜ ਦਾ ਕੰਮ ਜਿਹੜਾ ਉਹ ਅੱਜ ਕੱਲ੍ਹ ਬੜੇ ਲੋਕ ਕਰਵਾਉਂਦੇ ਪਏ ਆ ਅਤੇ ਫਿਰ ਉਹ ਲੋਕ ਬੈੱਡ ਬਣਾਉਂਦੇ ਆ ਬਾਰੀਆਂ ਬਣਾਉਂਦੇ ਆ ਦਰਵਾਜ਼ੇ ਬਣਾਉਂਦੇ ਆ ਮਤਲਬ ਕਿ ਬੜਾ ਹੀ ਲੱਕੜ ਦਾ ਕੰਮ ਕਰਦੇ ਆ ਜਿਹਦੇ ਨਾਲ ਕਿ ਉਹਨਾਂ ਨੂੰ ਸੈਲਰੀ ਮਿਲਦੀ ਆ ਫਿਰ ਉਹ ਗਰੀਬੀ ਵਰਗੀਆਂ ਜਿਹੜੀਆਂ ਸਮੱਸਿਆਵਾਂ ਵਾ ਉਹਨਾਂ ਤੋਂ ਦੂਰ ਰਹਿੰਦੇ ਆ ਅਤੇ ਸ਼ਹਿਰਾਂ 'ਚ ਕਈ ਲੋਕ ਮੇਕਅਪ ਆਰਟਿਸਟ ਸ਼ਹਿਰਾਂ 'ਚ ਜਿ ਕੁੜੀਆਂ ਹੁੰਦੀਆਂ ਵਾ ਉਹ ਮੇਕਅਪ ਆਰਟਿਸਟ ਦਾ ਕੰਮ ਕਰਦੀਆਂ ਵਾ ਉਹ ਜਿੱਦਾਂ ਕਿਸੇ ਨੇ ਵਿਆਹ ਸ਼ਾਦੀਆਂ 'ਤੇ ਜਾਣਾ ਵਹੁਟੀਆਂ ਨੂੰ ਤਿਆਰ ਕਰਦੀਆਂ ਵਾਂ ਉਹ ਕੁੜੀਆਂ ਵਹੁਟੀਆਂ ਨੂੰ ਤਿਆਰ ਕਰਦੀਆਂ ਵਾਂ ਅਤੇ ਕਈ ਜਿਹੜੇ ਆ ਉਹ ਟੈਟੂ ਬਣਾਉਂਦੇ ਆ ਮੁੰਡੇ ਟੈਟੂ ਮੇਕਿੰਗ ਦਾ ਕੰਮ ਕਰਦੇ ਆ ਇੱਦਾਂ ਹੀ ਮਤਲਬ ਕਿ ਜਿਹੜੇ ਲੋਕ ਆ ਉਹ ਆਪਦੇ ਕਿੱਤੇ ਕਰਦੇ ਆ ਅਤੇ ਉਹ ਆਪਦੀ ਤਰ੍ਹਾਂ ਪੈਸੇ ਵੱਟਦੇ ਆ ਅਤੇ ਉਹ ਗਰੀਬੀ ਵਰਗੀ ਸਮੱਸਿਆਵਾਂ ਤੋਂ ਦੂਰ ਰਹਿੰਦੇ ਆ ਅਤੇ ਲੋਕ ਇੱਦਾਂ ਹੀ ਆਪਦਾ ਗੁਜ਼ਾਰਾ ਕਰਦੇ ਆ